ਮੇਰੇ ਖਿਆਲ ਨਾਲ ਜਿਹੜੇ ਵੱਖ ਵੱਖ ਸਟਾਈਲ ਹੈ ਉਹਨਾਂ ਨੇ ਜਿਹੜਾ ਸਾਡਾ ਵਿਕਾਸ ਹੈ ਅਤੇ ਸਾਡਾ ਸੱਭਿਆਚਾਰ ਹੈ ਉਹਨੂੰ ਕੀ ਹੈ ਇੱਕ ਪਿੱਛੇ ਰੱਖਤਾ ਅਤੇ ਜਿਹੜਾ ਵੈਸਟਰਨ ਕਲਚਰ ਹੈ ਉਹ ਸਾਡੇ ਪਰ ਜ਼ਿਆਦਾ ਹਾਵੀ ਹੋਇਆ ਵਾ ਏ ਠੀਕ ਹੈ ਜਿਵੇਂ ਪੰਜਾਬ ਸਟੇਟ ਦੀ ਗੱਲ ਕਰ ਲੈਂਦੇ ਹੈ ਕਿ ਇੱਥੋਂ ਦਾ ਜਿਹੜਾ ਇੱਕ ਲੋਕ ਪਹਿਰਾਵਾ ਏ ਉਹ ਕਮੀਜ ਸਲਵਾਰ ਨੂੰ ਮੰਨਿਆ ਗਿਆ ਏ ਠੀਕ ਹੈ ਅਤੇ ਜਿਹੜਾ ਮੁੰਡੇ ਹੈ ਉਨ੍ਹਾਂ ਦਾ ਚਾਦਰਾ ਅਤੇ ਕੁੜਤਾ ਪਰ ਅੱਜ ਜੇ ਅਸੀਂ ਫੈਸ਼ਨ ਦੇਖੀਏ ਤਾਂ ਕੁੜੀਆਂ ਕੀ ਹੈ ਜੀਨਸ ਪਾ ਰਹੀਆਂ ਏ ਜਿਹੜਾ ਕਿ ਮੁੰਡਿਆਂ ਦੀ ਇੱਕ ਗਿਣੀ ਜਾਂਦੀ ਹੈ ਕਿ ਜੀ ਪੈਂਟ ਸ਼ਰਟ ਮੁੰਡੇ ਪਾਉਂਦੇ ਆ ਅਤੇ ਮੁੰਡੇ ਅੱਜ ਕੱਲ੍ਹ ਕੁੜੀਆਂ ਦੀਆਂ ਸਲਵਾਰਾਂ ਪਾ ਕੇ ਘੁੰਮ ਰਹੇ ਆ ਬਾਲ ਪਿੱਛੋਂ ਇੰਨੇ ਇੰਨੇ ਲੰਬੇ ਉਹਨਾਂ ਨੇ ਵਧਾਏ ਹੋਏ ਆ ਕਿ ਪਿੱਛੋਂ ਅਸੀਂ ਜੱਜ ਨਹੀਂ ਕਰ ਸਕਦੇ ਕਿ ਜਿਹੜਾ ਇਹ ਹੈ ਇਨਸਾਨ ਹੈ ਇਹ ਸਾਹਮਣੇ ਤੋਂ ਕੀ ਹੈ ਕੀ ਇਹ ਸਾਹਮਣੇ ਤੋਂ ਸਾਨੂੰ ਕੀ ਅਸੀਂ ਇਹਦੇ ਬਾਰੇ ਸੋਚ ਸਕਦੇ ਹੈ ਕਿ ਇਹ ਇੱਕ ਔਰਤ ਹੋਉਂਗੀ ਜਾਂ ਮਰਦ ਹੋਉਂਗਾ ਠੀਕ ਹੈ ਜੀ ਅਤੇ ਜਿਹੜਾ ਸੱਭਿਆਚਾਰ ਹੈ ਇਹ ਬਹੁਤ ਜ਼ਿਆਦਾ ਜਿਹੜਾ ਵੈਸਟਨ ਹੈ ਉਹ ਸਾਡੇ ਸੱਭਿਆਚਾਰ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਹਾਵੀ ਹੋ ਚੁੱਕਾ ਏ ਅੱਜ ਦੇ ਸਮੇਂ ਵਿੱਚ